ਪਸ਼ੂਆਂ ਦੀ ਤੰਦਰੁਸਤੀ ਦੀ ਜਿਹੜੀ ਜਾਂਚ ਹੈ ਉਹ ਪਸ਼ੂ ਦੇ ਖਾਣ ਪੀਣ ਤੋਂ ਪਤਾ ਲੱਗ ਜਾਂਦੀ ਹੈ ਸੋ ਜ਼ਿਆਦਾ ਉਸਦੀ ਜ਼ਰੂਰਤ ਨਹੀਂ ਪੈਂਦੀ ਪਸ਼ੂਆਂ ਦੀਆਂ ਜਿਹੜੀਆਂ ਆਮ ਬਿਮਾਰੀਆਂ ਨੇ ਜਿਹੜੀਆਂ ਰੂਟੀਨ ਦੇ ਵਿੱਚ ਪਸ਼ੂਆਂ ਨੂੰ ਆ ਸਕਦੀਆਂ ਨੇ ਜਿਵੇਂ ਬੁਖਾਰ ਆਉਣਾ ਜਾਂ ਪੈਰਾਂ ਦੀ ਬਿਮਾਰੀ ਹੋਣੀ ਜਾਂ ਮੂੰਹ ਵਾਲੀ ਬਿਮਾਰੀ ਹੈ ਜੋ ਉਹ ਜ਼ਿਆਦਾਤਰ ਬਹੁਤ ਚੱਲਦੀ ਹੈ ਸੋ ਇਹਨਾਂ ਨੂੰ ਦਵਾਈਆਂ ਦੇ ਰਾਹੀਂ ਜਾਂ ਅਸੀਂ ਘਰ ਦੇ ਵਿੱਚ ਹੀ ਇਹਨਾਂ ਨੂੰ ਸੌਖੇ ਢੰਗ ਦੇ ਨਾਲ ਠੀਕ ਕਰ ਸਕਦੇ ਹਾਂ ਜਿਹੜਾ ਪਸ਼ੂ ਪਾਲਦਾ ਹੈ ਉਹਨੂੰ ਇਹਨਾਂ ਬਿਮਾਰੀਆਂ ਬਾਰੇ ਪਤਾ ਹੁੰਦਾ ਹੈ ਸੋ ਇਸ ਕਰਕੇ ਉਹ ਬਿਮਾਰੀਆਂ ਨੂੰ ਘਰ ਦੇ ਵਿੱਚ ਵੀ ਠੀਕ ਕੀਤੀਆਂ ਜਾ ਸਕਦੀਆਂ ਹਨ ਕੋਈ ਜ਼ਿਆਦਾ ਜੋ ਆਮ ਬਿਮਾਰੀਆਂ ਨੇ ਉਹਨਾਂ ਨੂੰ ਮੈਡੀਸਨ ਦੀ ਲੋੜ ਪੈ ਦਵਾਈਆਂ ਦੀ ਲੋੜ ਨਹੀਂ ਪੈਂਦੀ